ਸਤਿ ਸ਼੍ਰੀ ਅਕਾਲ ਸਰ ਸਰ ਮੈਂ ਇੱਕ ਕੈਬ ਬੁੱਕ ਕਰਵਾਈ ਸੀ ਜੋ ਕਿ ਦੀਪਿਕਾ ਦੇ ਨੈਮ ਨਾਮ ਤੋਂ ਬੁੱਕ ਸੀਗੀ ਸਰ ਜਸਟ ਉਸ ਟਾਈਮ 'ਤੇ ਕਰੋਨਾ ਦਾ ਦੌਰ ਚੱਲ ਰਿਹਾ ਸੀ ਔਰ ਇਹ ਕੈਬ ਮੈਨੂੰ ਇੱਕ ਵਜੇ ਲੈਣ ਲਈ ਆਈ ਸਰ ਜਿਸ ਟਾਈਮ 'ਤੇ ਮੈਂ ਕੈਬ ਦੇ ਵਿੱਚ ਬੈਠਣਾ ਸੀ ਡਰਾਈਵਰ ਬਾਹਰ ਨਿਕਲੇ ਉਹਨਾਂ ਨੇ ਕੋਈ ਵੀ ਮਾਸਕ ਨਹੀਂ ਪਾਇਆ ਹੋਇਆ ਸੀ ਨਾ ਹੀ ਕੋਈ ਹੱਥ ਵਿੱਚ ਉਹਨਾਂ ਦੇ ਗਲਬਸ ਸੀਗੇ ਉਹਨਾਂ ਨੇ ਵਿਦਾਊਟ ਗਲਬਸ ਕੈਬ ਦਾ ਡੋਰ ਖੋਲ੍ਹਿਆ ਔਰ ਮੈਂ ਉਹਦੇ ਵਿੱਚ ਬੈਠੀ ਸੀਗੀ ਸਰ ਜਿਸ ਟਾਈਮ 'ਤੇ ਮੈਂ ਬੈਠੀ ਉਹਨਾਂ ਨੇ ਅੰਦਰ ਆ ਕੇ ਵੀ ਕੋਈ ਮਾਸਕ ਨਹੀਂ ਪਾਇਆ ਹੋਇਆ ਸੀ ਔਰ ਨਾ ਹੀ ਕੋਈ ਕੈਬ ਦੀ ਸਫਾਈ ਦੀ ਕੋਈ ਮੈਨੂੰ ਨਿਸ਼ਾਨ ਲੱਭ ਰਹੇ ਸਨ ਸਰ ਨਾ ਹੀ ਉਹਨਾਂ ਦੇ ਜੋ ਸੀਟਸ ਸੀਗੀਆਂ ਉਹ ਕਵਰਡ ਸੀਗੀਆਂ ਨਾ ਹੀ ਉਹ ਸੀਟ ਸੈਨੀਟਾਈਜਡ ਸੀਗੀਆਂ ਸਰ ਨਾ ਹੀ ਉਹਨਾਂ ਨੇ ਆਪਣੀ ਕੈਬ ਦੇ ਵਿੱਚ ਕੋਈ ਸੈਨੀਟਾਈਜ਼ਰ ਰੱਖਿਆ ਹੋਇਆ ਸੀ ਜਿਸ ਕਰਕੇ ਕਿ ਮੈਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਕਰਨਾ ਪਿਆ ਕਿਉਂਕਿ ਉਹ ਕੈਬ ਬਹੁਤ ਹੀ ਜ਼ਿਆਦਾ ਗੰਦੀ ਹੋਈ ਹੋਈ ਚੁੱਕੀ ਹੋ ਚੁੱਕੀ ਸੀ ਸਰ ਕਿਉਂਕਿ ਉਸ ਦਾ ਜੋ ਫਲੋਰਸ ਫਲੋਰ ਸੀ ਉਹ ਬਹੁਤ ਹੀ ਜ਼ਿਆਦਾ ਘੱਟੇ ਨਾਲ ਭਰਿਆ ਹੋਇਆ ਸੀ ਸਰ ਮੈਨੂੰ ਉਸ ਕੈਬ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਔਰ ਘਰ ਆ ਕੇ ਵੀ ਮੈਨੂੰ ਜਦੋਂ ਚੈੱਕਅਪ ਕਰਾਇਆ ਔਰ ਮੈਂ ਸੰਕ੍ਰਮਿਤ ਹੋਣ ਦੇ ਪੂਰੇ ਪੂਰੇ ਚਾਂਸਿਸ ਲੈ ਸਕਦੀ ਹਾਂ ਕਿਉਂਕਿ ਮੈਨੂੰ ਕੋਈ ਵੀ ਟੇਸਟ ਨਹੀਂ ਆ ਰਿਹਾ ਖਾਣੇ ਵਿੱਚ ਸਰ ਇਸ ਕਰਕੇ ਮੈਨੂੰ ਆਪਣੇ ਘਰਦਿਆਂ ਦੀ ਸੁਰਕਸ਼ਾ ਲਈ ਚੌਦਾਂ ਦਿਨ ਲਈ ਕੁਰੰਟੀਨ ਕੁਰੰਟਾਈਨ ਹੋਣਾ ਪੈ ਰਿਹਾ ਹੈ ਸਰ ਸਰ ਮੈਂ ਅਪੀਲ ਕਰਦੀ ਹਾਂ ਕਿ ਕ੍ਰਿਪਾ ਕਰਕੇ ਆਪਣੇ ਕੈਬਸ ਦੀ ਸਫਾਈ ਦੀ ਪੂਰੀ ਧਿਆਨ ਰੱਖੋ ਜਿਸ ਕਰਕੇ ਕਿ ਹੋਰ ਜੋ ਸ ਕੋਈ ਕੈਬ ਔਡਰ ਕਰੇ ਉਸ ਨੂੰ ਇਹ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਏ ਧੰਨਵਾਦ ਸਰ ਧੰਨਵਾਦ